ਅੱਜ ਕੱਲ੍ਹ ਦੇ ਗੀਤ ਬਹੁਤ ਹੀ ਜ਼ਿਆਦਾ ਅਵਾਜ਼ ਵਾਲੇ ਹੁੰਦੇ ਹਨ ਜਿਨ੍ਹਾਂ ਦੀ ਸਮਝ ਵੀ ਨਹੀਂ ਆਉਂਦੀ ਅੱਜ ਕੱਲ੍ਹ ਅੰਗਰੇਜ਼ੀ ਹਿੰਦੀ ਵਿੱਚ ਗੀਤ ਆਉਂ ਦੇ ਆਏ ਹਨ ਜੋ ਮੈਨੂੰ ਪਸੰਦ ਨਹੀਂ ਸੀ ਮੈਨੂੰ ਸਿਫ਼ਰ ਸਿਰਫ਼ ਲੋ ਗੀਤ ਲੋਕ ਗੀਤ ਪਸੰਦ ਹਨ ਪੰਜਾਬ ਗੀਤਾਂ ਦਾ ਦੇਸ ਹੈ ਹਰ ਇਕ ਪੰਜਾਬੀ ਗੀਤਾਂ ਦੀਆਂ ਗੀਤਾਂ ਦੀਆਂ ਧੁਨਾਂ ਨੂੰ ਜਮਦਾ ਲੋਰੀਆਂ ਵਿੱਚ ਪਾਲਦਾ ਮਈਆਂ ਅਤੇ ਢੋਲ ਢੋਲੇ ਗਾਉਂਦਾ ਜਵਾਨ ਹੁੰਦਾ ਹੈ ਬਚਪਨ ਵਿੱਚ ਜੋ ਬੱਚਾ ਖੇ ਬੱਚੇ ਖੇਡਦੇ ਹਨ ਬਾਤਾਂ ਅਤੇ ਬੁਝਾਰਤਾਂ ਪਾਉਂਦੇ ਹਨ ਉਹ ਇਹ ਸਾਰਾ ਕੁਝ ਲੋਕ ਗੀਤ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ ਇਨ੍ਹਾਂ ਗੀਤਾਂ ਨੂੰ ਲਿਖਣ ਵਾਲੇ ਦਾ ਕੋਈ ਕੋਈ ਜਿਤਨਾ ਨਹੀਂ ਹੈ